ਪੇਂਡੂ ਆਬਾਦੀ ਨੂੰ ਅਕਸਰ ਕਾਨੂੰਨੀ ਸੇਵਾਵਾਂ ਤੱਕ ਪਹੁੰਚ ਕਰਨ ਵਿੱਚ ਵਿਲੱਖਣ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਵਿੱਚ ਵਕੀਲਾਂ ਪੁਲਿਸ ਸਟੇਸ਼ਨਾਂ ਅਤੇ ਅਦਾਲਤਾਂ ਤੱਕ ਪਹੁੰਚ ਕਰਨ ਵਿੱਚ ਮੁਸ਼ਕਲਾਂ ਸ਼ਾਮਿਲ ਹੋ ਸਕਦੀਆਂ ਹਨ ਪੇਂਡੂ ਲੋਕਾਂ ਲਈ ਕਾਨੂੰਨੀ ਸੇਵਾਵਾਂ ਵਿੱਚ ਕੁਝ ਮੁੱਖ ਮੁਸ਼ਕਲਾਂ ਵਿੱਚ ਸ਼ਾਮਿਲ ਹਨ ਭੂਗੋਲਿਕ ਦੂਰੀ ਪੇਂਡੂ ਖੇਤਰ ਅਕਸਰ ਵਕੀਲਾਂ ਦੇ ਦਫਤਰ ਪੁਲਿਸ ਸਟੇਸ਼ਨ ਅਤੇ ਅਦਾਲਤਾਂ ਸਮੇਤ ਕਾਨੂੰਨੀ ਸੇਵਾ ਪਰਦਾਤਾਵਾਂ ਲਈ ਲੰਬੀ ਦੂਰੀ ਦੁਆਰਾ ਦਰਸਾਏ ਜਾਂਦੇ ਹਨ ਸੀਮਿਤ ਆਵਾਜਾਈ ਦੇ ਵਿਕਲਪ ਅਤੇ ਬੁਨਿਆਦੀ ਢਾਂਚਾ ਪੇਂਡੂ ਵਸਨੀਕਾਂ ਲਈ ਸ਼ਹਿਰੀ ਕੇਂਦਰਾਂ ਦੀ ਯਾਤਰਾ ਕਰਨਾ ਮੁਸ਼ਕਲ ਬਣਾ ਸਕਦਾ ਹੈ ਜਿੱਥੇ ਕਾਨੂੰਨੀ ਸੇਵਾਵਾਂ ਵਧੇਰੇ ਆਸਾਨੀ ਨਾਲ ਉਪਲਬਧ ਹਨ ਵਕੀਲਾਂ ਦੀ ਸੀਮਿਤ ਉਪਲਬਧਤਾ ਪੇਂਡੂ ਖੇਤਰਾਂ ਵਿੱਚ ਵਕੀਲਾਂ ਦੀ ਕਮੀ ਹੋ ਸਕਦੀ ਹੈ ਖਾਸ ਤੌਰ 'ਤੇ ਉਹ ਜਿਹੜੇ ਕਾਨੂੰਨ ਦੇ ਖਾਸ ਖੇਤਰਾਂ ਜਿਵੇਂ ਕਿ ਪਰਿਵਾਰਕ ਕਾਨੂੰਨ ਜਾਇਦਾਦ ਕਾਨੂੰਨ ਜਾਂ ਰੁਜ਼ਗਾਰ ਕਾਨੂੰਨ ਵਿੱਚ ਮਾਹਰ ਹਨ ਨਤੀਜੇ ਵਜੋਂ ਪੇਂਡੂ ਵਸਨੀਕ ਆਪਣੀਆਂ ਕਾਨੂੰਨ ਲੋੜਾਂ ਲਈ ਕਾਨੂੰਨੀ ਪ੍ਰਤੀਨਿਧਤਾ ਲੱਭਣ ਲਈ ਸੰਘਰਸ਼ ਕਰ ਸਕਦੇ ਹਨ ਕਾਨੂੰਨੀ ਸਹਾਇਤਾ ਸੇਵਾਵਾਂ ਦੀ ਘਾਟ ਕਾਨੂੰਨੀ ਸਹਾਇਤਾ ਸੇਵਾਵਾਂ ਜੋ ਘੱਟ ਆਮਦਨੀ ਵਾਲੇ ਵਿਅਕਤੀਆਂ ਨੂੰ ਮੁਫਤ ਜਾਂ ਘੱਟ ਕੀਮਤ ਵਾਲੇ ਕਾਨੂੰਨ ਸਹਾਇਤਾ ਪ੍ਰਦਾਨ ਕਰਦੀਆਂ ਹਨ ਪੇਂਡੂ ਖੇਤਰਾਂ ਵਿੱਚ ਘੱਟ ਜਾਂ ਗੈਰ ਮੌਜੂਦ ਹੋ ਸਕਦੀਆਂ ਹਨ ਪੇਂਡੂ ਖੇਤਰਾਂ ਵਿੱਚ ਘੱਟ ਜਾਂ ਗੈਰ ਮੌਜੂਦ ਹੋ ਸਕਦੀਆਂ ਨੇ ਇਹ ਸੀਮਿਤ ਵਿੱਚ ਸਰੋਤਾਂ ਵਾਲੇ ਪੇਂਡੂ ਵਸਨੀਕਾਂ ਨੂੰ ਕਾਨੂੰਨੀ ਨੁਮਾਇੰਦਗੀ ਜਾਂ ਉਸ ਬਰਦਾਸ਼ਤ ਕਰਨ ਵਿੱਚ ਅਸਮਰਥ ਛੱਡ ਸਕਦਾ ਹੈ ਘੱਟ ਸਟਾਫ ਵਾਲੇ ਪੁਲੀਸ ਸਟੇਸ਼ਨ ਦਿਹਾਤੀ ਖੇਤਰਾਂ ਦੇ ਪੁਲਿਸ ਸਟੇਸ਼ਨ ਘੱਟ ਸਟਾਫ ਅਤੇ ਸਰੋਤਾਂ ਤੋਂ ਘੱਟ ਹੋ ਸਕਦੇ ਹਨ ਜਿਸ ਨਾਲ ਐਮਰਜੈਂਸੀ ਦਾ ਜਵਾਬ ਦੇਣ ਜੁਰਮਾਂ ਦੀ ਜਾਂਚ ਕਰਨ ਅਤੇ ਅਪਰਾਧ ਦੇ ਪੀੜਤਾਂ ਨੂੰ ਸਹਾਇਤਾ ਪ੍ਰਦਾਨ ਕਰਨ ਵਿੱਚ ਦੇਰੀ ਹੋ ਸਕਦੀ ਹੈ ਸੀਮਿਤ ਪੁਲਿਸ ਦੀ ਮੌਜੂਦਗੀ ਵੀ ਪੇਂਡੂ ਵਸਨੀਕਾਂ ਵਿੱਚ ਅਸੁਰੱਖਿਆ ਅਤੇ ਕਮਜ਼ੋਰੀ ਦੀਆਂ ਭਾਵਨਾਵਾਂ ਵਿੱਚ ਯੋਗਦਾਨ ਪਾ ਸਕਦੀ ਹੈ ਆਦਾਲਤੀ ਬੈਕਲੋਗ ਪੇਂਡੂ ਅਦਾਲਤਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਵੇਂ ਕਿ ਸੀਮਿਤ ਨਿਆਂਇਕ ਸਰੋਤ ਕੇਸਾਂ ਦਾ ਬੈਕਲਾਗ ਅਤੇ ਅਦਾਲਤੀ ਸੁਣਵਾਈਆਂ ਨੂੰ ਤਹਿ ਕਰਨ ਵਿੱਚ ਦੇਰੀ ਇਸ ਦੇ ਨਤੀਜੇ ਵਜੋਂ ਦਿਹਾਤੀ ਵਸਨੀਕਾਂ ਨੂੰ ਆਪਣੇ ਕਾਨੂੰਨੀ ਝਗੜਿਆਂ ਦਾ ਹੱਲ ਲੱਭਣ ਲਈ ਲੰਬੀ ਉਡੀਕ ਕਰਨੀ ਪੈ ਸਕਦੀ ਹੈ ਨਿਆਂ ਤੱਕ ਪਹੁੰਚ ਅਤੇ ਕਾਨੂੰਨੀ ਮਾਮਲਿਆਂ ਦੇ ਸਮੇਂ ਸਿਰ ਹੱਲ ਨੂੰ ਪ੍ਰਭਾਵਿਤ ਕਰਦਾ ਹੈ ਸੱਭਿਆਚਾਰਕ ਅਤੇ ਭਾਸ਼ਾਈ ਰੁਕਾਵਟਾਂ ਪੇਂਡੂ ਆਬਾਦੀ ਵਿੱਚ ਵੱਖ ਵੱਖ ਸੱਭਿਆਚਾਰਕ ਪਿਛੋਕੜਾਂ ਅਤੇ ਭਾਸ਼ਾਵਾਂ ਵਾਲੇ ਵੀ ਪਿੰਡ ਭਾਈਚਾਰੇ ਸ਼ਾਮਿਲ ਹੋ ਸਕਦੇ ਹਨ ਭਾਸ਼ਾ ਦੀਆਂ ਰੁਕਾਵਟਾਂ ਅਤੇ ਸੱਭਿਆਚਾਰਕ ਸੰਵੇਦਨਸ਼ੀਲਤਾ ਕਾਨੂੰਨੀ ਸੇਵਾਵਾਂ ਤੱਕ ਪਹੁੰਚ ਕਰਨ ਕਾਨੂੰਨੀ ਪ੍ਰਕਿਰਿਆਵਾਂ ਨੂੰ ਸਮਝਣ ਅਤੇ ਕਾਨੂੰਨੀ ਪੇਸ਼ੇਵਰਾਂ ਨੂੰ ਨਾਲ ਸ ਪ੍ਰਭਾਵਸ਼ਾਲੀ ਢੰਗ ਨਾਲ ਸੰਚਾਰ ਕਰਨ ਵਿੱਚ ਚੁਣੌਤੀਆਂ ਪੈਦਾ ਕਰ ਸਕਦੀਆਂ ਹਨ ਡਿਜੀਟਲ ਵੰਡ ਪੇਂਡੂ ਖੇਤਰਾਂ ਵਿੱਚ ਇੰਟਰਨੈਟ ਕਨੈਟਿਵਿਟੀ ਅਤੇ ਡਿਜੀਟਲ ਤਕਨੋਲੋਜੀ ਤੱਕ ਸੀਮਿਤ ਪਹੁੰਚ ਹੋ ਸਕਦੀ ਹੈ ਜਿਸ ਨਾਲ ਪੇਂਡੂ ਵਸਨੀਕਾਂ ਲਈ ਔਨਲਾਈਨ ਕਾਨੂੰਨੀ ਸਰੋਤਾਂ ਜਾਣਕਾਰੀ ਅਤੇ ਸੇਵਾਵਾਂ ਤੱਕ ਪਹੁੰਚ ਕਰਨਾ ਮੁਸ਼ਕਲ ਹੋ ਸਕਦਾ ਹੈ ਡਿਜੀਟਲ ਸਾਖਰਤਾ ਦੀ ਘਾਟ ਅਤੇ ਔਨਲਾਈਨ ਕਾਨੂੰਨੀ ਸਾਧਨਾਂ ਦੀ ਜਾਗਰੂਕਤਾ ਪੇਂਡੂ ਵਸਨੀਕਾਂ ਦੀਆਂ ਆਪਣੀਆਂ ਕਾਨੂੰਨੀ ਲੋੜਾਂ ਨੂੰ ਪੂਰਾ ਕਰਨ ਦੀ ਯੋਗਤਾ ਨੂੰ ਹੋਰ ਰੁਕਾਵਟ ਦੇ ਸਕਦੀ ਹੈ ਪੇਂਡੂ ਆਬਾਦੀ ਨੂੰ ਅਕਸਰ ਕਾਨੂੰਨੀ ਸੇਵਾਵਾਂ ਤੱਕ ਪਹੁੰਚ ਕਰਨ ਵਿੱਚ ਵਿਲੱਖਣ ਚੁਣੋਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ